ਹੈਲੋ ਹੈਲੋ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਅੰਕਲ ਜੀ ਤੁਸੀਂ ਮੁਕਤਸਰ ਤੋਂ ਬੋਲਦੇ ਹੋ ਜੀ ਹਾਂਜੀ ਅੰਕਲ ਮੁਕਤਸਰ ਤੋਂ ਗੁਰਦੀਪ ਸੁਨਿਆਰਾ ਹਾਂਜੀ ਅੰਕਲ ਜੀ ਅਸੀਂ ਪਿੰਡ ਇਥੋਂ ਨਾਲ ਵਾਲੇ ਪਿੰਡ ਤੋਂ ਬੋਲਦੇ ਆਹਾਂ ਅਤੇ ਹਾਂਜੀ ਅੰਕਲ ਜੀ ਮੈਂ ਵੀ ਉਹਨਾਂ ਦੀ ਬੇਟੀ ਆ ਰੁਪਿੰਦਰ ਸਿੰਘ ਦੀ ਤਾਮਕੋਟ ਜੀ ਹਾਂਜੀ ਅੰਕਲ ਜੀ ਆਪਣੇ ਨਾ ਮੈਰਿਜ ਅੰਕਲ ਅਤੇ ਉਹਦੇ ਲਈ ਨਾ ਆਪਾਂ ਵੀ ਆ ਸੋਨੇ ਬਾਰੇ ਦਾ ਰੇਟ ਪਤਾ ਕਰਨਾ ਸੀਗਾ ਕਿੰਨਾ ਚੱਲਦਾ ਅੰਕਲ ਅੱਜ ਕੱਲ੍ਹ ਹਾਂਜੀ ਠੀਕ ਆ ਅੰਕਲ ਜੀ ਉਹ ਤਾਂ ਜੀ ਮੈਂ ਪੁਰਾਣੇ ਜਿਵੇਂ ਆਪਣੇ ਹੁੰਦੇ ਨਾ ਰੀਤੀ ਰਿਵਾਜਾਂ ਵਾਲੇ ਜਿਵੇਂ ਹੋਗੇ ਹੈ ਨਾ ਪੁਰਾਣਾ ਸਾਰਾ ਉਹ ਸੈੱਟ ਤਿਆਰ ਕਰਵਾਉਣਾ ਹੈ ਤੁਸੀਂ ਕਰ ਦਓਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਜਿਵੇਂ ਟਿੱਕਾ ਹੋ ਗਿਆ ਇੱਕ ਹੈ ਨਾ ਇੱਕ ਝੰਬਲ ਸੂਈ ਹੁੰਦੀ ਹੈ ਹਾਂਜੀ ਹਾਂਜੀ ਹਾਂਜੀ ਅੰਕਲ ਜੀ ਮੈਂ ਪਿੱਪਲ ਪੱਤੀਆਂ ਹੋ ਗਈਆਂ ਹੈ ਨਾ ਪੁਰਾਣਾ ਇੱਕ ਰਾਣੀ ਹਾਰ ਅਤੇ ਇਹ ਹਾਂਜੀ ਹਾਂਜੀ ਇੱਕ ਅੰਕਲ ਉਹ ਜਿਹੜੇ ਹੁੰਦੇ ਆ ਨਾ ਅੰਗੂਰਾਂ ਦੀ ਵੇਲ ਵਾਲੇ ਕਾਂਟੇ ਬਣਾਉਂਦੇ ਨੇ ਹੈਨਾ ਹਾਂਜੀ ਹਾਂਜੀ ਹਾਂਜੀ ਉਹ ਸਾ ਹਾਂਜੀ ਹਾਂਜੀ ਅੰਕਲ ਸਾਰਾ ਪੁਰਾਣਾ ਹੀ ਬਣਾਉਣਾ ਵੀ ਜਿਵੇਂ ਟਿੱਕਾ ਹੋ ਗਿਆ ਇੱਕ ਤਾਂ ਇਹ ਹਾਂਜੀ ਹਾਂਜੀ ਇੱਕ ਸੱਗੀ ਫੁੱਲ ਹੋ ਗਏ ਹੈਨਾ ਇੱਕ ਹੋ ਗਈ ਝੰਬਰ ਸੂਈ ਅਤੇ ਕਲਿੱਪ ਹੁੰਦੇ ਨੇ ਇੱਕ ਜਿਵੇਂ ਪਹਿਲਾਂ ਚਲਦੇ ਸੀਗੇ ਹਾਂਜੀ ਹਾਂਜੀ ਅਤੇ ਹਾਂਜੀ ਹਾਂਜੀ ਪਿੱਪਲ ਪੱਤੀਆਂ ਹੋ ਗੀਆਂ ਹਾਂਜੀ ਹਾਂਜੀ ਇੱਕ ਅੰਕਲ ਜੀ ਉਹ ਮੋਹਰਾਂ ਨੀਂ ਹੁੰਦੀਆਂ ਸੀ ਗੋਲ ਗੋਲ ਬਣਾਉਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਤੇਅ ਉਹ ਮੋਹਰਾਂ ਵੀ ਬਣਵਾਉਣੀਆਂ ਜੀ ਹਾਂਜੀ ਉਹ ਵੀ ਬਣਵਾਉਣੀ ਅੰਕਲ ਅਤੇ ਅੰਕਲ ਤੁਹਾਡੇ ਕੋਲ ਬਣੇ ਵੇ ਹੈਗੇ ਆ ਕਿ ਬ ਤੁਸੀਂ ਬਣਾਓ ਵੀ ਜਦੋਂ ਅਸੀਂ ਦੇ ਕੇ ਗਏ ਔਡਰ ਉਦੋਂ ਬਣਾਓਗੇ ਅਤੇ ਡਿਜਾਇਨ ਹੈਗੇ ਤੁਹਾਡੇ ਕੋਲ ਹਾਂਜੀ ਅੰਕਲ ਜੀ ਅਸੀਂ ਐਂ ਹੀ ਕਰਾਂਗੇ ਫਿਰ ਅਸੀਂ ਨਾਲ ਤਾਂ ਤੁਹਾਡੇ ਕੋਲ ਜਿਹੜੇ ਬਣੇ ਹੋਏ ਉਹ ਦੇਖ ਜਾਵਾਂਗੇ ਹੈਨਾ ਅਤੇ ਨਾਲ ਤੁਸੀਂ ਵੀ ਆ ਤੁਹਾਨੂੰ ਦਿਖਾ ਦਵਾਂਗੇ ਵੀ ਜਿਹੜੇ ਸਾਨੂੰ ਜ਼ਰੂਰਤ ਆ ਵੀ ਮਤਲਵ ਜਿਹੜੇ ਜਿਹੜੇ ਅਸੀਂ ਬਣਾਉਣੇ ਆ ਡਿਜਾਇਨ ਹਾਂਜੀ ਅੰਕ ਅੰਕਲ ਜੀ ਕੱਲ੍ਹ ਤੁਸੀਂ ਦੁਕਾਨ 'ਤੇ ਹੋਵੋਂਗੇ ਜੀ ਹਾਂਜੀ ਬਾਕੀ ਅੰਕਲ ਤੁਸੀਂ ਪਤਾ ਕੀ ਕਰਿਓ ਤੁਸੀਂ ਆਏਂ ਕਰਿਓ ਵੀ ਸਾਰੇ ਜਿਹੜੇ ਤੁਹਾਡੇ ਹੈ ਨਾ ਡਿਜਾਇਨ ਹੋਏ ਤੁਸੀਂ ਸਾਰੇ ਲਿਆ ਕੇ ਰੱਖਿਓ ਹੈ ਨਾ ਵੀ ਅਤੇ ਫਿਰ ਚਾਹੇ ਵੀ ਫਿਰ ਉਹ ਨਾ ਹੋਵੇ ਵੀ ਸਾਨੂੰ ਸਾਰੇ ਦਿਖਾ ਦਿਓ ਹੈ ਨਾ ਹਾਂਜੀ ਅੰਕਲ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਅੰਕਲ ਜੀ ਕਿੰਨੇ ਕੁ ਟਾਈਮ 'ਚ ਤਿਆਰ ਹੋ ਜਾਂਦੇ ਆ ਜੀ ਇਹ ਹਾਂਜੀ ਮਹੀਨਾ ਕੁ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਹੋ ਜਾਣਗੇ ਜੀ ਹਾਂਜੀ ਚਲੋ ਠੀਕ ਆ ਹਾਂਜੀ ਚਲੋ ਅੰਕਲ ਜੀ ਠੀਕ ਆ ਫਿਰ ਕੱਲ੍ਹ ਨੂੰ ਜੀ ਮੈਂ ਅਤੇ ਮਮੀ ਡੈਡੀ ਨਾਲ ਆਊਂਗੀ ਅਤੇ ਫਿਰ ਅਸੀਂ ਸਾਰਾ ਡਿਸਾਈਡ ਕਰਕੇ ਹੈ ਨਾ ਤੁਹਾਨੂੰ ਦੱਸ ਜਾਵਾਂਗੇ ਜੀ ਹਾਂਜੀ ਅੰਕਲ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ